ਅਸੀਂ ਜ਼ਿਆਦਾਤਰ ਬਾਹਰ ਦੇ ਹੋਟਲਾਂ ਢਾਬਿਆਂ ਵਿੱਚ ਅਜਿਹੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਾਂ ਜਿਹੜੀਆਂ ਕਿ ਨੌਰਮਲੀ ਅਸੀਂ ਘਰਾਂ ਵਿੱਚ ਜ਼ਿਆਦਾਤਰ ਨਹੀਂ ਖਾ ਖਾ ਸਕਦੇ ਜ਼ਿਆਦਾ ਜ਼ਿਆਦਾਤਰ ਬਣਾ ਨਹੀਂ ਸਕਦੇ ਜਿਕਣਾ ਕਿ ਫਾਸਟ ਫੂਡ ਵਗੈਰਾ ਹੋ ਗਿਆ ਅਜਿਹੀਆਂ ਚੀਜ਼ਾਂ ਅਸੀਂ ਘਰ ਵਿੱਚ ਬਹੁਤ ਘੱਟ ਬਣਾ ਸਕਦੇ ਹਾਂ ਅਤੇ ਅਸੀਂ ਬਾਹਰ ਜਾ ਕੇ ਸਾਡੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਹੀ ਖਾਈਏ ਜਿਹੜੀਆਂ ਕਿ ਅਸੀਂ ਘਰ ਨਹੀਂ ਬਣਾ ਸਕਦੇ ਜਿਹੜੀਆਂ ਅਸੀਂ ਕਦੇ ਕਦੇ ਖਾਣੀਆ ਹੋਵੇ